ਮੈਂ ਇੱਕ ਸਿਲਾਈ ਟੀਚਰ ਸੀ ਸਿਲਾਈ ਕਰਦੀ ਵੀ ਰਹੀ ਹਾਂ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਸੀ ਲੋਕਾਂ ਨੂੰ ਮੇਰੇ ਕੱਪੜੇ ਸਿਲਾਈ ਕੀਤੇ ਹੋਏ ਬੜੇ ਪਸੰਦ ਆਉਂਦੇ ਸੀ ਅਤੇ ਫਿਰ ਮੈਂ ਉਹਨਾਂ ਦੇ ਨਾਲ ਨਾਲ ਨਵੇਂ ਡਿਜ਼ਾਇਨ ਤਿਆਰ ਕਰਦੀ ਰਹਿੰਦੀ ਸੀ ਹਰ ਇੱਕ ਡਿਜ਼ਾਇਨ ਅਲੱਗ ਅਲੱਗ ਖੁਸ਼ ਹੋ ਕੇ ਫਿਰ ਦੁਬਾਰਾ ਗਾਹਕ ਮੇਰੇ ਪਾਸ ਆਉਂਦਾ ਸੀ ਜਿਸ ਦੇ ਨਾਲ ਮੈਂ ਮੇਰੀ ਇਹ ਆਮਦਨੀ ਵੀ ਸੀ ਇਸਦੇ ਨਾਲ ਮੈਂ ਆਪਣੇ ਘਰ ਦਾ ਖਰਚਾ ਵੀ ਚਲਾਉਂਦੀ ਰਹੀ ਹਾਂ ਖੁਸ਼ ਰਹਿੰਦੀ ਸੀ ਅੱਜ ਕੱਲ੍ਹ ਮੈਂ ਆਪਣਾ ਕੰਮ ਇਹ ਬੰਦ ਕਰ ਦਿੱਤਾ ਹੈ ਕਿਉਂਕਿ ਮੇਰੇ ਏਜ ਦੇ ਨਾਲ ਨਾਲ ਮੈਂ ਆਪਣਾ ਕੰਮ ਇਹ ਬੰਦ ਕਰ ਦਿੱਤਾ ਓ